ਮੈਂ ਸਿਮਰਨਜੀਤ ਸਿੰਘ ਅਰਬਨ ਸਟੇਟ ਕਪੂਰਥਲਾ ਤੋਂ ਗੱਲ ਕਰ ਰਿਹਾ ਹਾਂ ਮੈਂ ਫਰੈਸ਼ ਫੂਡ ਡੋਟ ਕਾਮ ਰਾਹੀਂ ਖਾਣੇ ਦਾ ਆਰਡਰ ਕੀਤਾ ਸੀ ਮੇਰੇ ਵੱਲੋਂ ਦਾਲ ਮੱਖਣੀ ਸ਼ਾਹੀ ਪਨੀਰ ਅਤੇ ਪੰਦਰਾਂ ਰੋਟੀਆਂ ਅਤੇ ਸਲਾਦ ਦਾ ਆਰਡਰ ਦਿੱਤਾ ਗਿਆ ਸੀ ਮੇਰਾ ਰਿਫ ਰੈਫਰੈਂਸ ਨੰਬਰ ਇਕਵੰਜਾ ਪੰਜਾਹ ਹੈ ਇਸ ਆਰਡਰ ਕੀਤੇ ਨੂੰ ਲਗਭਗ ਇੱਕ ਘੰਟੇ ਦਾ ਸਮਾਂ ਬੀਤ ਗਿਆ ਹੈ ਪਰੰਤੂ ਅਜੇ ਵੀ ਮੇਰਾ ਮੇਰਾ ਆਰਡਰ ਮੇਰੇ ਤੱਕ ਅਜੇ ਡਿਲੀਵਰ ਨਹੀਂ ਹੋਇਆ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਆਰਡਰ ਪਹੁੰਚਣ ਤੱਕ ਕਿੰਨਾ ਸਮਾਂ ਲੱਗੇਗਾ ਕਿਉਂਕਿ ਔਨਲਾਈਨ ਐਪ ਐਪ 'ਤੇ ਇਸ ਸਬੰਧੀ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ ਕਿ ਮੈਂ ਆਪ ਜੀ ਵੱਲੋਂ ਆਰਡਰ ਡਿਲੀਵਰੀ ਹੋਇਆ ਹੈ ਜਾਂ ਨਹੀਂ ਹੋਇਆ ਮੈਂ ਅਤੇ ਮੇਰੇ ਦੋਸਤ ਆਰਡਰ ਦੀ ਉਡੀਕ ਕਰ ਰਹੇ ਹਾਂ ਜੇਕਰ ਤੁਹਾਡੇ ਵੱਲੋਂ ਆਰਡਰ ਡਿਲੀਵਰੀ ਨਹੀਂ ਹੋਇਆ ਤਾਂ ਕਿਰਪਾ ਕਰਕੇ ਮੈਨੂੰ ਦੱਸ ਦਿੱਤਾ ਜਾਵੇ ਤਾਂ ਜੋ ਕਿ ਮੈਂ ਕਿਸੇ ਹੋਰ ਰੈਸਟੋਰੈਂਟ ਤੋਂ ਆਰਡਰ ਬੁੱਕ ਕਰ ਸਕਾਂ ਅਤੇ ਮੇਰੀ ਪੇਮੈਂਟ ਵੀ ਮੈਨੂੰ ਵਾਪਿਸ ਕੀਤੀ ਜਾਵੇ ਜੇ ਤੁਹਾਡੇ ਵੱਲੋਂ ਮੇਰਾ ਆਰਡਰ ਅਜੇ ਨਹੀਂ ਹੋਇਆ ਤਾਂ ਠੀਕ ਆ ਜੀ